ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਵੀ ਹਾਂਜੀ ਮੈਂ ਵੀ ਪਿੰਡ ਪੱਖੀ ਕਲਾਂ ਤੋਂ ਬੋਲ ਰਹੀ ਹਾਂ ਹਾਂ ਫਸਲ ਐਤਕੀ ਫਸਲ ਦਾ ਝਾੜ ਥੋੜ੍ਹਾ ਜਿਹਾ ਘੱਟ ਹੋਇਆ ਹੈ ਜਿਹੜੀ ਹੁਣ ਮੰਡੀ 'ਚ ਸੁੱਟੀ ਗਈ ਆ ਹੋਰ ਆਹ ਜਿਹੜੀ ਕ ਕ ਝੋਨਾ ਹੋਇਆ ਹੁਣ ਇਹਦੇ 'ਚ ਝਾੜ ਜਿਹਾ ਥੋੜ੍ਹਾ ਜਿਹਾ ਘੱਟ ਨਿਕਲਿਆ ਹੈ ਗਰੀਨ ਗਰੀਨ ਰੈਵੂਲਿਓਸ਼ਨ ਗਰੀਨ ਰੈਵੂਲਿਓਸ਼ਨ ਐਸ ਐਸ ਸਵਾਮੀਨਾਥਨ ਨੇ ਸ਼ੁਰੂ ਕੀਤਾ ਸੀ ਅਤੇ ਇਹ ਉੱਨੀ ਸੌ ਸੱਠ ਅਤੇ ਉਨੀ ਸੌ ਸੱਤਰ ਦੇ ਵਿੱਚ ਟਾਈਮ ਆ ਜਦੋਂ ਇਹ ਸ਼ੁਰੂ ਹੋਇਆ ਸੀ ਅਤੇ ਇਹਦੇ 'ਚ ਵੀਟ ਰਾਈਸ ਅ ਸਾਰੀਆਂ ਪੈ ਪੈਦਾਵਾਰ ਸੀ ਹੋਰ ਫ ਫਾਦਰ ਔਫ ਫਾਦਰ ਔਫ ਗਰੀਨ ਰੈਵੂਲਿਊਸ਼ਨ ਔਰ ਇਹਨਾਂ ਨੇ ਹਰੀ ਕ੍ਰਾਂਤੀ ਸ਼ੁਰੂ ਕੀਤੀ ਸੀ ਉੱਨੀ ਸੌ ਸੱਠ ਅਤੇ ਸੱਤਰ ਦੇ ਵਿੱਚ ਵਿੱਚ ਹਾਂ ਇਹਨਾਂ ਨੇ ਉਹਨਾਂ ਕਿਸਾਨਾਂ ਲਈ ਸਹੂਲਤ ਦਿੱਤੀ ਸੀ ਇਹ ਹਰੀ ਕ੍ਰਾਂਤੀ ਉਹਨਾਂ ਵੇਲਿਆਂ 'ਚ ਆਈ ਸੀ ਉਨੀ ਸੌ ਸ ਸੱਠ ਤੋਂ ਛਿਆਹਠ ਦੇ ਵਿੱਚ ਵਿੱਚ ਅਤੇ ਉਹਨਾਂ ਨੇ ਕਿਸਾਨਾਂ ਦੇ ਬੈਨੀਫਿਟ ਲਈ ਸ਼ੁਰੂ ਕੀਤੀ ਸੀ ਗਰੀਨ ਰੈਵੂਲਿਓਸ਼ਨ ਹਾਂਜੀ ਹੋਰ ਦੱਸੋ ਗਰੀਨ ਹਾਂ ਬਸ ਕਿਸਾਨਾਂ ਨੂੰ ਤਾਂ ਕਿ ਵੱਧ ਤੋਂ ਵੱਧ ਇਹਨੂੰ ਪ੍ਰੋਫਿਟ ਪ੍ਰਾਪਤ ਹੋ ਸਕੇ ਜਾ ਹਾਂ ਸਾਰੇ ਕਿਸਾਨਾਂ ਨੂੰ ਲਾਭ ਮਿਲ ਸਕੇ ਵੱਧ ਤੋਂ ਵੱਧ ਇਹਨਾਂ ਦਾ ਗਰੀਨ ਰੈਵੂਲਿਓਸ਼ਨ ਨਾਲ ਇਹਦੇ ਨਾਲ ਕਿਸਾਨਾਂ ਨੂੰ ਵਾਧਾ ਬੜਾ ਹੋਊਗਾ ਫਸਲਾਂ ਹੋਰ ਦੱਸੋ ਕੀ ਹਾਂ ਇਹਦੇ ਨਾਲ ਲੇਟੇਸਟ ਆਲ ਰੋਜ਼ਾਨਾ ਦੀਆਂ ਸਾਰੀਆਂ ਪ੍ਰੋਬਲਮਸ ਖਤਮ ਹੋ ਜਾਣੀਆਂ ਦਿਲ ਕਰਦਾ ਹੋਊਗਾ ਮਿੱਟੀ ਨੂੰ ਬੈਨੀਫਿਟ ਹੋਣਗੇ ਕਈ ਤਰ੍ਹਾਂ ਦੀਆਂ ਦਵਾਈਆਂ ਵੀ ਪ੍ਰੋਵਾਈਡ ਕੀਤੀਆਂ ਇਸ ਰੈਵੂਲਿਓਸ਼ਨ ਦੇ ਜ਼ਰੀਏ ਬਟ ਇਹਦੇ ਨਾਲ ਠੀਕ ਹੈ

ਓਕੇ